ਸਤਾਰ੍ਹਾਂ ਅਪ੍ਰੈਲ ਉੱਨੀ ਸੌ ਪਚਾਸੀ ਤੀਹ ਅਪ੍ਰੈਲ ਉੱਨੀ ਸੌ ਬਿਆਸੀ ਇਕੱਤੀ ਜਨਵਰੀ ਦੋ ਹਜ਼ਾਰ ਦਸ ਸਤਾਈ ਜਨਵਰੀ ਦੋ ਹਜ਼ਾਰ ਤਿੰਨ ਅਠਾਈ ਅਕਤੂਬਰ ਦੋ ਹਜ਼ਾਰ ਨੌਂ